ਮੈਂ ਅੰਸ਼ੁਲ ਅਤੇ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ ਕਿ ਕੁਝ ਸਮਾਂ ਪਹਿਲਾਂ ਮੈਂ ਆਪਣੇ ਨਜ਼ਦੀਕ ਦੇ ਰੈਸਟੋਰੈਂਟ ਸਾਂਝਾ ਚੁੱਲ੍ਹਾ ਤੋਂ ਕੁਝ ਆਈਟਮਾਂ ਦਾ ਔਡਰ ਕੀਤਾ ਸੀ ਅਤੇ ਜਦੋਂ ਉਹ ਔਡਰ ਮੈਨੂੰ ਮਿਲਿਆ ਤਾਂ ਮੈਂ ਉਸਨੂੰ ਦੇਖ ਕੇ ਬਹੁਤ ਨਿਰਾਸ਼ ਹੋਇਆ ਕਿਉਂਕਿ ਇੱਕ ਤਾਂ ਉਸ ਵਿੱਚ ਬਹੁਤ ਮਸਾਲੇ ਸਨ ਅਤੇ ਉਹ ਬਹੁਤ ਤੇਲ ਨਾਲ਼ ਵੀ ਭਰਿਆ ਹੋਇਆ ਸੀ ਪਰ ਜਦੋਂ ਉਹ ਔਡਰ ਮੈਂ ਚੱਖਣ ਦੀ ਕੋਸ਼ਿਸ਼ ਕੀਤੀ ਉਸ ਤੋਂ ਇਲਾਵਾ ਉਹ ਬਹੁਤ ਬੇਸੁਆਦਾ ਸੀ ਅਤੇ ਉਸ ਵਿੱਚ ਕਈ ਆਈਟਮਾਂ ਤਾਂ ਹੈ ਹੀ ਨਹੀਂ ਸੀ ਜਿਸ ਕਾਰਨ ਮੈਂ ਬਹੁਤ ਨਿਰਾਸ਼ ਹੋਇਆ ਅਤੇ ਮੈਂ ਰੈਸਟੋਰੈਂਟ ਨੂੰ ਇਹੀ ਬੇਨਤੀ ਕਰਨਾ ਚਾਹਵਾਂਗਾ ਕਿ ਕਿਰਪਾ ਕਰਕੇ ਮੇਰਾ ਔਡਰ ਵਾਪਸ ਕੀਤਾ ਜਾਵੇ ਅਤੇ ਮੈਨੂੰ ਮੇਰੀ ਬਣਦੀ ਰਕਮ ਵੀ ਵਾਪਸ ਕੀਤੀ ਜਾਵੇ ਕਿਉਂਕਿ ਇਹ ਔਡਰ ਮੇਰੀਆਂ ਉਮੀਦਾਂ ਦੇ ਮੁਤਾਬਕ ਨਹੀਂ ਸੀ ਅਤੇ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਵਾਂਗਾ ਕਿ ਮੈਨੂੰ ਰੈਸਟੋਰੈਂਟ ਵੱਲੋਂ ਇਹ ਉਮੀਦ ਨਹੀਂ ਸੀ ਅਤੇ ਕਿਰਪਾ ਕਰਕੇ ਮੇਰੇ ਪੈਸੇ ਅਤੇ ਮੇਰਾ ਔਡਰ ਵਾਪਸ ਕੀਤਾ ਜਾਵੇ ਧੰਨਵਾਦ